ਇਲੈਕਟ੍ਰੋਨਿਕ ਸੰਸਕਰਨ ਜਿਵੇਂ ਕਿ ਸੈਂਸਰਾਂ ਬਾਰੇ ਮੇਰੀ ਬੜੀ ਰੁਚੀ ਹੈ ਜਿਵੇਂ ਕਿ ਅਸੀਂ ਰੋਬਰਟ ਸੈਂਸਰਾਂ ਦੇ ਨਾਲ ਜੁੜ ਕੇ ਅਸੀਂ ਉਹਦੇ ਵਿੱਚ ਅਪਰੋਕਸੀਮਿਟੀ ਸੈਂਸਰ ਲਗਾ ਕੇ ਏ ਅਤੇ ਵੋਇਸ ਸੈਂਸਰ ਲਗਾ ਕੇ ਉਹਨਾਂ ਨੂੰ ਕੰਟਰੋਲ ਕਰ ਸਕਦੇ ਹਾਂ ਰੋਬਟ ਬਣਾਉਣ ਦੇ ਵਿੱਚ ਸਾਡੀ ਬੜੀ ਰੁਚੀ ਹੈ ਉਹਦੇ ਵਿੱਚ ਚ ਕਰ੍ਹਾਂ ਤਰ੍ਹਾਂ ਦੇ ਸ ਤਰ੍ਹਾਂ ਦੇ ਸੈਂਸਰ ਲੱਗਦੇ ਹਨ ਮੋਟਰਾਂ ਲੱਗਦੀਆਂ ਹਨ ਸਰਬੋ ਮੋਟਰਾਂ ਲੱਗਦੀ ਹਨ ਅਤੇ ਨਾਲ ਹੀ ਪ੍ਰੋਗਰਾਮਿੰਗ ਹੁੰਦੀ ਹੈ ਅਤੇ ਉਹਦੇ ਨਾਲ ਅਸੀਂ ਬੱਚਿਆਂ ਨੂੰ ਵੀ ਪੜ੍ਹਾ ਸਕਦੇ ਹਾਂ ਅਤੇ ਖੁਦ ਵੀ ਇਹਦੇ ਵਿੱਚ ਬਹੁਤ ਹੀ ਮੱਲਾਂ ਤਰੱਕੀਆਂ ਮਾਰ ਸਕ ਮਾ ਮਾਣ ਸਕਦੇ ਹਾਂ ਅਤੇ ਆਡੀਓ ਬੁੱਕਾਂ ਬਾਰੇ ਮੇਰੀ ਇੰਨੀ ਕੋਈ ਨੌਲੇਜ ਨਹੀਂ ਹੈ ਆਡੀਓ ਬੁੱਕਾਂ ਮੈਂ ਨਹੀਂ ਸੁਣਦਾ ਹਾਂ ਅਤੇ ਮੇਰੀ ਕੋਈ ਇਹਦੇ ਵਿੱਚ ਜ਼ਿਆਦਾ ਰੁਚੀ ਨਹੀਂ ਹੈ